ਪੰਜਾਬੀ ਭਾਸ਼ਾ ਦੀ ਲਿੱਪੀ ਗੁਰਮੁਖੀ ਲਿੱਪੀ ਹੈ ਇਹ ਗੁਰਮੁਖੀ ਲਿੱਪੀ ਗੁਰੂ ਸਾਹਿਬਾਨਾਂ ਦੁਆਰਾ ਬਣਾਈ ਗਈ ਹੈ ਅਤੇ ਇਹ ਗੁਰੂਆਂ ਪੀਰਾਂ ਦੀ ਇਹ ਪੰਜਾਬੀ ਭਾਸ਼ਾ ਹੈ ਇਸ ਵਿੱਚ ਬਹੁਤ ਸਾਰਾ ਮੱਧਕਾਲੀਨ ਸਾਹਿਤ ਮਿਲਦਾ ਹੈ ਜਿਸ ਵਿੱਚ ਗੁਰੂ ਸਾਹਿਬਾਨਾਂ ਭੱਟਾਂ ਭਗਤਾਂ ਦੀ ਬਾਣੀ ਦਰਜ ਹੈ ਐਂਡ ਇਸਦੀ ਜੇਕਰ ਅਸੀਂ ਵਿਚਾ ਆ ਵਿਆਕਰਨਕ ਵਿਸ਼ੇਸ਼ਤਾ ਦੀ ਗੱਲ ਕਰੀਏ ਤਾਂ ਇਸ ਵਿੱਚ ਬਹੁਤ ਸੋਹਣੀਆਂ ਲਗਾ ਮਾਤਰਾਵਾਂ ਅਤੇ ਬਹੁਤ ਸੋਹਣਾ ਉਚਾਰਨ ਹੈ ਅਤੇ ਬਹੁਤ ਸੋਹਣੇ ਸ਼ਬਦ ਹਨ ਅਤੇ ਬਹੁਤ ਸਾਰੇ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਇਸਦੇ ਵਿੱਚ ਦੇਖਣ ਨੂੰ ਮਿਲਦੀਆਂ ਹਨ ਐਂਡ ਬਹੁਤ ਸਾਰੇ ਗੀਤ ਸੰਗੀਤ ਦੇ ਖੇਤਰ ਦੇ ਵਿੱਚ ਦੇਖੀਏ ਤਾਂ ਪੰਜਾਬੀ ਭਾਸ਼ਾ ਦਾ ਵਿੱਚ ਪੰਜਾਬੀ ਭਾਸ਼ਾ ਦਾ ਬਹੁਤ ਸਾਰਾ ਲਿਟਰੇਚਰ ਮਿਲਦਾ ਹੈ ਸਾਨੂੰ ਪੰਜਾਬੀ ਭਾਸ਼ਾ ਇੱਕ ਅਜਿਹੀ ਭਾਸ਼ਾ ਹੈ ਜਿਸਨੂੰ ਬਹੁ ਬਹੁਤ ਸਰਲ ਅਤੇ ਸੌਖੇ ਤਰੀਕੇ ਨਾਲ ਬੋਲਿਆ ਜਾ ਸਕਦਾ ਹੈ ਐਂਡ ਬਹੁਤ ਸਰਲ ਅਤੇ ਸੌਖੇ ਤਰੀਕੇ ਦੇ ਨਾਲ ਸਿੱਖਿਆ ਜਾ ਸਕਦਾ ਹੈ ਪੰਜਾਬੀ ਭਾਸ਼ਾ ਇੱਕ ਸਾਡੀ ਮਾਤ ਭਾਸ਼ਾ ਹੈ ਇਸ ਭਾਸ਼ਾ ਨੂੰ ਅਸੀਂ ਵਰਲਡਵਾਈਡ ਪ੍ਰਮੋਟ ਕੀਤਾ ਹੈ ਐਂਡ ਜਿੱਥੇ ਕਿਤੇ ਵੀ ਸਾਡਾ ਪੰਜਾਬੀ ਵੀਰ ਜਾਂ ਕੋਈ ਐੱਨ ਆਰ ਆਈ ਵੀਰ ਰਹਿੰਦਾ ਹੈ ਉਹ ਦੇਸ਼ ਵਿਦੇਸ਼ ਦੇ ਵਿੱਚ ਵੀ ਇਸ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦਾ ਯਤਨ ਕਰਦਾ ਹੈ ਪੰਜਾਬੀ ਭਾਸ਼ਾ ਇੱਕ ਅਜਿਹੀ ਭਾਸ਼ਾ ਹੈ ਜਿੱਥੇ ਜਿ ਜਿਸਨੂੰ ਹਰ ਇੱਕ ਚਾਹੇ ਉਹ ਕਿਸੇ ਲੈਂਗੂਏਜ ਦਾ ਵਿਅਕਤੀ ਕਿਉਂ ਨਾ ਹੋਵੇ ਉਹ ਸੁਣਨਾ ਚਾਹੁੰਦਾ ਹੈ